ਸਾਡੇ ਖੇਤਰ ਵਿੱਚ ਰਵਾਇਤੀ ਖੇਡਾਂ ਇਹ ਹਨ ਜਿਵੇਂ ਕਿ ਕੋਟਲਾ ਛਪਾਕੀ ਖੋ ਖੋ ਲੁਕਣ ਮਿੱਚੀ ਛੂ ਮਾਟੀ ਗੁੱਲੀ ਡੰਡਾ ਪਿੱਠੂ ਗਰਮ ਸਟੈਪੂ ਅਤੇ ਆਦਿ ਖੇਡਾਂ ਹਨ ਅਸੀਂ ਸਾਰੇ ਇਸ ਨੂੰ ਰਲ ਮਿਲ ਕੇ ਗਲੀ ਵਿੱਚ ਖੇਡਦੇ ਹਾਂ ਅਸੀਂ ਆਂਢ ਗੁਆਂਢ ਸਾਰਾ ਇਕੱਠਾ ਹੋ ਜਾਂਦਾ ਹੈ ਅਤੇ ਸਾਡੇ ਮਾ ਮੰਮੀਆਂ ਥੜ੍ਹੇ 'ਤੇ ਬੈਠ ਜਾਂਦੀਆਂ ਹਨ ਅਤੇ ਸਾਨੂੰ ਖੇਡਦੇ ਹੋਏ ਦੇਖਦੇ ਹਨ ਅਸੀਂ ਆਪਣੇ ਸਕੂਲ ਦਾ ਕੰਮ ਖਤਮ ਕਰਕੇ ਗਲੀ ਵਿੱਚ ਖੇਡਣ ਚਲੇ ਜਾਂਦੇ ਹਾਂ ਸਾਨੂੰ ਖੇਡਣ ਵਿੱਚ ਬਹੁਤ ਹੀ ਮਜ਼ਾ ਆਉਂਦਾ ਹੈ ਅਤੇ ਸਾਡੀ ਸਿਹਤ ਤੰਦਰੁਸਤ ਰਹਿੰਦੀ ਹੈ ਅਤੇ ਦਿਮਾਗ ਨੂੰ ਵੀ ਤੰਦਰੁਸਤ ਰੱਖਦੀ ਹੈ ਅਤੇ ਇਸ ਨਾਲ ਪੜ੍ਹਾਈ ਵਿੱਚ ਬਹੁਤ ਵਧੀਆ ਧਿਆਨ ਲੱਗਦਾ ਹੈ ਅਤੇ ਅਸੀਂ ਸਟਾਪੂ ਆਪਣੀ ਛੱਤ ਉੱਪਰ ਖੇਲਦੇ ਹਾਂ ਅਤੇ ਇਹ ਛੇ ਖਾਨਿਆਂ ਵਾਲੀ ਅਤੇ ਬਿੱਲੀ ਸਟੈਪੂ ਵੀ ਹੁੰਦੀ ਹੈ ਅਸੀਂ ਇਸ ਨੂੰ ਬਹੁਤ ਮਜ਼ੇ ਨਾਲ ਖੇਲਦੇ ਹਾਂ